ਹਾਂ ਮੈਂ ਜਾਣਦਾ ਹਾਂ ਜੋ ਕਿ ਖੇਡਣ ਨੂੰ ਆਪਣਾ ਕਰੀਅਰ ਸਮਝਦਾ ਹੈ ਮੇਰਾ ਦੋਸਤ ਹੀ ਹੈ ਜਿਹਦਾ ਨਾਂ ਹਰਮਨਜੀਤ ਸਿੰਘ ਹੈ ਬਚਪਨ ਤੋਂ ਹੀ ਅਸੀਂ ਨਾਲ ਖੇਡਦੇ ਰਹੇ ਹਾਂ ਅਤੇ ਸਕੂਲ ਵੀ ਛੋਟੇ ਹੁੰਦੇ ਤੋਂ ਮੇਰੇ ਨਾਲ ਹੀ ਪੜ੍ਹਦਾ ਰਿਹਾ ਹੈ ਹੈਗਾ ਵੀ ਨਾਲੇ ਮੇਰਾ ਗੁਆਂਢੀ ਹੈ ਜੋ ਕਿ ਪੜ੍ਹਾਈ ਦੇ ਵਿੱਚ ਤਾਂ ਠੀਕ ਠਾਕ ਹੈ ਜੰ ਜਾਂ ਅਸੀਂ ਇੱਦਾਂ ਨਹੀਂ ਕਹਿ ਸਕਦੇ ਵੀ ਜ਼ਿਆਦਾ ਹੁਸ਼ਿਆਰ ਹੈ ਜਾਂ ਇੱਦਾਂ ਵੀ ਨਹੀਂ ਕਹਿ ਸਕਦੇ ਵੀ ਉਹ ਨਲਾਇਕ ਹੈ ਠੀਕ ਠਾਕ ਜਿਹਾ ਕਹਿ ਸਕਦੇ ਹਾਂ ਜਿਵੇਂ ਵੀ ਐਵਰੇਜ ਪਰ ਉਹ ਗੇਮ ਗੇਮਾਂ ਜ਼ਰੂਰ ਖੇਡਦਾ ਹੈ ਜਿਵੇਂ ਕਿ ਕ੍ਰਿਕਟ ਖੇਡਣ ਜਾਂਦਾ ਹੈ ਸੈਚਰਡੇ ਸੰਨਡੇ ਜਿਵੇਂ ਵੀ ਛੁੱਟੀ ਹੁੰਦੀ ਹੈ ਤਾਂ ਉਹ ਸਵੇਰੇ ਚੱਲ ਜਾਂਦਾ ਨੌ ਕੁ ਵਜੇ ਇੱਥੋਂ ਅਤੇ ਲਾਗੇ ਗਰਾਊਡਾਂ ਹੈਗੀਆਂ ਵਾ ਤੋਂ ਆਪਣੇ ਯਾਰ ਬੇਲੀਆਂ ਨਾਲ ਉੱਥੇ ਕ੍ਰਿਕਟ ਖੇਡਣ ਚੱਲ ਜਾਂਦਾ ਫੇਰ ਸ਼ਾਮ ਨੂੰ ਆਉਂਦਾ ਵਾ ਹੋਰ ਵੀ ਉਹਦਾ ਗੇਮਾਂ ਵਿੱਚ ਬੜਾ ਸਾਰਾ ਇੰਨਟਰੱਸਟ ਹੈਗਾ ਵਾ ਜਿੰਨਾ ਜਿੱਦਾਂ ਉਹ ਸਮੇਂ ਦਾ ਵੀ ਮੈਂ ਪੜ੍ਹਾਈ ਦੇ ਵਿੱਚ ਤਾਂ ਠੀਕ ਠਾਕ ਹੀ ਹਾਂ ਇੰਨਾ ਨਹੀਂ ਪਰ ਉਹ ਗੇਮ ਦੇ ਵਿੱਚ ਆਪਣੇ ਆਪ ਨੂੰ ਦੂਜਿਆਂ ਨਾਲੋਂ ਵਧੀਆ ਸਮਝਦਾ ਵਾ ਉਹ ਸਮਝਦਾ ਵੀ ਜਿੱਦਾਂ ਮੈਂ ਕ੍ਰਿਕਟ ਬਹੁਤ ਵਧੀਆ ਖੇਡਦਾ ਅਤੇ ਉਹਨੂੰ ਲੱਗਦਾ ਵਾ ਵੀ ਸ਼ਾਇਦ ਥੋੜ੍ਹੇ ਹੀ ਸਮੇਂ ਤੱਕ ਉਹ ਅੱਗੇ ਇੰਡੀਅਨ ਇੰਡੀਆ ਟੀਮ ਵਾਸਤੇ ਖੇਡ ਸਕਦਾ ਅਤੇ ਉਹਦੇ ਵਿੱਚ ਉਹਦੀ ਸਿਲੈਕਸ਼ਨ ਹੋ ਸਕਦੀ ਹੈ ਉਹਨੂੰ ਲੱਗਦਾ ਹੈ ਵੀ ਉਹਦੇ ਵਿੱਚ ਹੀ ਮੇਰਾ ਸ਼ਾਇਦ ਕੀ ਪਤਾ ਕਰੀਅਰ ਬਣ ਜੇ ਅਤੇ ਮੈਨੂੰ ਗਵਰਮੈਂਟ ਜੋਬ ਮਿਲ ਜੇ ਅਤੇ ਵਿਦਿਆਰਥੀ ਸਕੂਲ ਵਿੱਚ ਖੇਡਾਂ ਵਿੱਚ ਹਿੱਸਾ ਲੈਂਦੇ ਹਨ ਕਿਉਂਕਿ ਹੁਣ ਤਾਂ ਬਹੁਤ ਸਾਰੇ ਸਕੂਲਾਂ ਵਿੱਚ ਗੇਮਾਂ ਖਿਡਾਈਆਂ ਜਾਂਦੀਆਂ ਜ਼ਰੂਰੀ ਨਹੀਂ ਵੀ ਪੜ੍ਹਾਈ ਦੇ ਵਿੱਚ ਹੀ ਉਨ੍ਹਾਂ ਨੂੰ ਲੱਗਦਾ ਸਟੂਡੈਂਟ ਨੂੰ ਵੀ ਸਾਰੀ ਦਿਹਾੜੀ ਅਸੀਂ ਪੜ੍ਹਾਈ ਪੜ੍ਹਦੇ ਰਹੀਏ ਥੋੜ੍ਹਾ ਬਹੁਤਾ ਸਾਡਾ ਖੇਡਾਂ ਵਿੱਚ ਵੀ ਇੰਨਟਰੱਸਟ ਹੋਣਾ ਚਾਹੀਦਾ ਇਸ ਕਰਕੇ ਸਾਰੇ ਸਕੂਲਾਂ ਵਿੱਚ ਗੇਮਾਂ ਖਿਡਾਈਆਂ ਜਾਂਦੀਆਂ ਹਨ ਥੈਂਕ ਯੂ